ਦੋ ਹਜ਼ਾਰ ਤੇਰਾਂ ਦੇ ਵਿੱਚ ਮੈਂ ਇੱਕ ਗੁਰਦੁਆਰਾ ਸਾਹਿਬ ਦੇ ਲਈ ਯਾਤਰਾ ਕੀਤੀ ਹੇਮਕੁੰਟ ਸਾਹਿਬ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਲਈ ਅਸੀਂ ਸਕੂਲ ਦੇ ਨਾ ਸੈ ਸਕੂਲ ਦੇ ਨਾਲ ਇੱਕ ਟ੍ਰਿਪਸ ਟ੍ਰਿਪ ਦੇ ਵਿੱਚ ਸੈਂਟ ਕਾਰਮਲ ਸਕੂਲ ਕਟਲੀ ਦੇ ਨਾਲ ਇੱਕ ਟ੍ਰਿਪ ਗਿਆ ਸੀ ਅਤੇ ਉਸਦੇ ਨਾਲ ਇੱਕ ਯਾਤਰਾ ਕੀਤੀ ਸਭ ਤੋਂ ਪਹਿਲਾਂ ਅਸੀਂ ਟਿੱਬੀ ਸਾਹਿਬ ਗੁਰਦੁਆਰਾ ਗੁਰਦੁਆਰੇ ਦੇ ਵਿੱ ਰੋਪੜ ਦੇ ਵਿੱਚ ਅਰਦਾਸ ਕਰਵਾਈ ਕਿ ਸਾਡੀ ਯਾਤਰਾ ਸਫਲ ਰਹੇ ਅਤੇ ਅਸੀਂ ਟਿੱਬੀ ਸਾਹਿਬ ਤੋਂ ਹੁੰਦੇ ਹੋਏ ਪਾਉਂਟਾ ਸਾਹਿਬ ਗੁਰਦੁਆਰਾ ਪਾਉਂਟਾ ਸਾਹਿਬ ਗੁਰਦੁਆਰਾ ਦੇ ਲਈ ਰਵਾਨਾ ਹੋ ਗਏ ਅਤੇ ਪਾਉਂਟਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਲਈ ਫਿਰ ਰਵਾਨਾ ਹੋਏ ਅਤੇ ਉੱਥੇ ਸਾਡੇ ਕੁਝ ਦੇਰ ਦੇ ਲਈ ਸਮ ਹੂੰ ਹੂੰ ਸਟੇਅ ਹੋਈ ਅਤੇ ਸਾਨੂੰ ਕੁਝ ਦੇਰ ਦੇ ਲਈ ਰੁਕਣਾ ਪਿਆ ਉੱਥੇ ਗੱਡੀਆਂ ਦੀ ਪਾਸਿੰਗ ਹੋਈ ਉੱਥੇ ਫਿਰ ਅਸੀਂ ਕੁਝ ਦੇਰ ਘੁੰਮਣ ਲਈ ਘੁੰਮਣ ਦੇ ਲਈ ਆਸ ਪਾਸ ਚਲੇ ਗਏ ਉੱਥੇ ਲਛਮਣ ਝੂਲਾ ਸੀ ਦੇਖਣ ਦੇ ਲਈ ਅਤੇ ਉਸ ਤੋਂ ਬਾਅਦ ਅਸੀਂ ਗੱਡੀਆਂ ਦੀ ਪਾਸਿੰਗ ਹੋਣ ਤੋਂ ਬਾਅਦ ਅਸੀਂ ਫਿਰ ਸ਼੍ਰੀਨਗਰ ਗੁਰਦੁਆਰਾ ਸਾਹਿਬ ਦੇ ਲਈ ਰਵਾਨਾ ਹੋ ਗਏ ਉੱਥੇ ਜਾ ਕੇ ਅਸੀਂ ਰਾਤ ਰੁਕੇ ਅਤੇ ਫਿਰ ਉਸ ਉਸ ਤੋਂ ਅਗਲੇ ਦਿਨ ਸ ਅਸੀਂ ਕੁਝ ਟਾਈਮ ਦੇ ਕੁਝ ਟਾਈਮ ਪਾ ਕੇ ਅਸੀਂ ਜੋਸ਼ੀਮੱਠ ਗੁਰੂਦਵਾਰਾ ਸਾਹਿਬ ਦੇ ਵਿੱਚ ਪਹੁੰਚ ਗਏ ਉੱਥੇ ਕੁਝ ਦੇਰ ਰੁਕੇ ਅਤੇ ਉੱਥੇ ਆਸ ਪਾਸ ਦੇਖਿਆ ਆਸ ਪਾਸ ਦਾ ਮਾਹੌਲ ਦੇਖਿਆ ਉੱਥੇ ਵੀ ਬਹੁਤ ਸਾਰੇ ਪਾਣੀ ਦੇ ਝਰਨੇ ਅਤੇ ਪਹਾੜ ਬਹੁਤ ਅੱਛੇ ਪਹਾੜਾਂ ਦੇ ਦ੍ਰਿਸ਼ ਸੀ ਅਤੇ ਉਸ ਤੋਂ ਬਾਅਦ ਅਸੀਂ ਮੇਨ ਆਪਣੇ ਗੁਰਦੁਆਰਾ ਗੋਬਿੰਦ ਘਾਟ ਦੇ ਲਈ ਰਵਾਨਾ ਹੋਏ ਅਤੇ ਗੋਬਿੰਦ ਘਾਟ ਸ ਪਹੁੰਚਦੇ ਪਹੁੰਚਦੇ ਸਾਨੂੰ ਸ਼ਾਮ ਹੋ ਗਈ ਅਤੇ ਗੋਬਿੰਦ ਘਾਟ ਦੇ ਵਿੱਚ ਅਸੀਂ ਰਾਤ ਰੁਕ ਕੇ ਅਤੇ ਦੂਜੇ ਦਿਨ ਅਸੀਂ ਪਹਾੜ ਆਪਣੇ ਗੁਰਦੁਆਰਾ ਧਾਮ ਦੇ ਲਈ ਚੜ੍ਹਾਈ ਚੜ੍ਹਨੀ ਸ਼ੁਰੂ ਕਰਨੀ ਸੀ ਅਤੇ ਉੱਥੇ ਜਿਹੜੀ ਗੋਬਿੰਦ ਘਾਟ ਤੋਂ ਗੋਬਿੰਦ ਘਾਟ ਤੋਂ ਲੈ ਕੇ ਗੋਬਿੰਦਧਾਮ ਤੱਕ ਬਾਰਾਂ ਕਿਲੋਮੀਟਰ ਦੀ ਚੜ੍ਹਾਈ ਸੀ ਅਤੇ ਉਹ ਵਾਲੀ ਪਹਾ ਪਹਾੜੀ ਰਸਤਾ ਸੀ ਬਹੁਤ ਕਦੇ ਸਿੱਧਾ ਰਸਤਾ ਸੀ ਬਹੁਤ ਜ਼ਿਆਦਾ ਉੱਥੇ ਬਰਫ਼ ਪੈਂਦੀ ਆ ਰਸਤਿਆਂ ਦੇ ਵਿੱਚ ਪਹੁੰਚਣ ਦੇ ਲਈ ਅਸੀਂ ਆਪਣੀ ਟਰੈ ਟਰੈਕਿੰਗ ਸਟਾਰਟ ਕੀਤੀ ਅਤੇ ਉੱਥੇ ਜਾ ਪਹੁੰਚਦੇ ਪਹੁੰਚਦੇ ਅਸੀਂ ਗੋਬਿੰਦ ਧਾਮ ਰਸਤੇ ਦੇ ਵਿੱਚ ਬਹੁਤ ਸਾਰੇ ਹੋਰਸ ਹੋਰਸ ਘੋੜਿਆਂ ਦੀ ਚੜ੍ਹਾਈ ਸੀ ਅਤੇ ਲੋਕ ਆਪਸ ਦੇ ਉੱਥੇ ਘੁੰਮ ਅਹ ਕੋਈ ਘੋੜਿਆਂ 'ਤੇ ਜਾ ਰਿਹਾ ਸੀ ਅਤੇ ਕੋਈ ਪਹਾੜਾਂ 'ਤੇ ਉਹਦੇ 'ਤੇ ਘੋੜਿਆਂ 'ਤੇ ਚੜ੍ਹ ਰਿਹਾ ਸੀ ਕੋਈ ਪੈਦਲ ਯਾਤਰਾ ਕਰ ਰਿਹਾ ਸੀ